ਅਗਰ ਗੱਲ ਕੀਤੀ ਜਾਵੇ ਫੇਸਬੁੱਕ ਦੀ ਮੈਨੂੰ ਫੇਸਬੁੱਕ ਬਹੁਤ ਹੀ ਜ਼ਿਆਦਾ ਪਸੰਦ ਹੈ ਇਸ ਵਿੱਚ ਬਹੁਤ ਸਾਰੀਆਂ ਨਿਊਜ਼ਾਂ ਅਤੇ ਕਈ ਸ਼ਹਿਰਾਂ ਦੀਆਂ ਕਈਆਂ ਦੇਸ਼ਾਂ ਦੀਆਂ ਨਿਊਜ਼ ਆਉਂਦੀਆਂ ਹਨ ਮੈਨੂੰ ਫੇਸਬੁੱਕ ਦੇ ਵਿੱਚ ਅਗਰ ਆਪਾਂ ਗੱਲ ਕੀਤੀ ਜਾਵੇ ਮੈਨੂੰ ਫੇਸਬੁੱਕ ਦੇ ਵਿੱਚ ਆਪਣਾ ਪੋਸਟਾਂ ਪਾਉਣੀਆਂ ਬਹੁਤ ਪਸੰਦ ਹੈ ਮੈਂ ਆਪਣੀ ਕੋਈ ਵੀ ਫੋਟੋ ਕਿਸੇ ਵੀ ਪ੍ਰਕਾਰ ਬਾਹਰ ਕਿਤੇ ਘੁੰਮਣ ਫਿਰਨ ਜਾਂਦਾ ਹਾਂ ਉਹ ਮੈਨੂੰ ਉੱਥੇ ਫੋਟੋ ਉਹ ਵਿੱਚ ਫੇਸਬੁੱਕ ਦੇ ਪਾਉਣੀ ਮੈਨੂੰ ਬਹੁਤ ਪਸੰਦ ਹੈ ਮੈਨੂੰ ਆਪਣੀ ਫੈਮਲੀ ਦੇ ਨਾਲ਼ ਅਗਰ ਆਪਾਂ ਦੇਖਿਆ ਜਾਵੇ ਫੈਮਲੀ ਦੇ ਨਾਲ਼ ਮੈਨੂੰ ਫੋਟੋ ਪਾਉਣੀ ਵੀ ਬਹੁਤ ਪਸੰਦ ਹੈ ਫੇਸਬੁੱਕ ਦੇ ਉੱਪਰ ਅਤੇ ਆਪਾਂ ਅਗਰ ਤੀਜੀ ਗੱਲ ਕਰਾਂਗੇ ਤੀਜੀ ਗੱਲ ਫੇਸਬੁੱਕ ਮੈਨੂੰ ਬਹੁਤ ਹੀ ਜ਼ਿਆਦਾ ਮਨੋਰੰਜਨ ਅਤੇ ਬਹੁਤ ਹੀ ਅੱਛੀ ਐਪ ਲੱਗਦੀ ਹੈ ਫੇਸਬੁੱਕ ਆਈ ਤਾਂ ਬਹੁਤ ਟਾਈਮ ਪਹਿਲਾਂ ਸੀ ਜਿਸ ਟਾਈਮ ਬਹੁਤ ਹੀ ਜ਼ਿਆਦਾਤਰ ਛੋਟੇ ਛੋਟੇ ਫੋਨ ਹੁੰਦੇ ਸਨ ਪਹਿਲਾਂ ਇਹ ਛੋਟੇ ਫੋਨਾਂ ਦੇ ਉੱਪਰ ਚੱਲਦੀ ਹੁੰਦੀ ਸੀ ਅਤੇ ਹੁਣ ਜਦੋਂ ਜਦੋਂ ਟੈਕਨੋਲਜੀ ਅੱਗੇ ਵੱਧਦੀ ਜਾ ਰਹੀ ਹੈ ਉਸ ਹਿਸਾਬ ਦੇ ਨਾਲ਼ ਫੇਸਬੁੱਕ ਦਾ ਅੱਗੇ ਤੋਂ ਅੱਗੇ ਗਰੋਥ ਵੀ ਵੱਧਦਾ ਜਾ ਰਿਹਾ ਹੈ ਇਸ ਵਿੱਚ ਆਉਣ ਵਾਲੇ ਟਾਈਮ ਦੇ ਨਾਲ਼ ਨਾਲ਼ ਨਵੇਂ ਨਵੇਂ ਅਪਡੇਟ ਹੁੰਦੇ ਜਾ ਰਹੇ ਹਨ ਆਪਾਂ ਕਈ ਅਪਡੇਟਾਂ ਦੀ ਗੱਲ ਕਰੀਏ ਪਹਿਲਾਂ ਫੇਸਬੁੱਕ ਦੇ ਵਿੱਚ ਸਟੇਟਸ ਦਾ ਬਹੁਤ ਹੀ ਘੱਟ ਔਪਸ਼ਨ ਹੁੰਦੀ ਸੀ ਸਟੇਟਸ ਤੀਹ ਪੰਦਰ੍ਹਾਂ ਸੈਕਿੰਡ ਤੋਂ ਜ਼ਿਆਦਾ ਦਾ ਨਹੀਂ ਪੈਂਦਾ ਸੀ ਹੁਣ ਉਹ ਤੀਹ ਸੈਕਿੰਡ ਦਾ ਪੈ ਸਕਦਾ ਹੈ ਹੁਣ ਉਹ ਇੱਕ ਮਿੰਟ ਦਾ ਦੋ ਮਿੰਟ ਦਾ ਜਿੰਨੇ ਮਿੰਟ ਦਾ ਆਪਾਂ ਪਾਉਣਾ ਚਾਹੇ ਆਪਾਂ ਉਹ ਸਟੇਟਸ ਨੂੰ ਆਪਾਂ ਪਾ ਸਕਦੇ ਹਾਂ ਅਗਰ ਹੁਣ ਆਪਾਂ ਦੂਜੇ ਤਰੀਕੇ ਦੀ ਗੱਲ ਕੀਤੀ ਜਾਵੇ ਫੇਸਬੁੱਕ ਦੀ ਅੱਗੇ ਕੀ ਔਪਸ਼ਨ ਆਈ ਹੈ ਅੱਗੇ ਹੁਣ ਫੇਸਬੁੱਕ ਦੇ ਵਿੱਚ ਰੀਲਜ਼ ਨਾਮ ਦੀ ਔਪਸ਼ਨ ਆਈ ਹੈ ਹੁਣ ਆਪਾਂ ਚਲੋ ਮੈਂ ਤਾਂ ਨਹੀਂ ਪਾਉਂਦਾ ਬਟ ਆਪਾਂ ਇਸ ਟੋਪਿਕ 'ਤੇ ਗੱਲ ਸਿਰਫ ਕਰ ਰਹੇ ਹਾਂ ਕਿ ਰੀਲਜ਼ ਨਾਮ 'ਤੇ ਬੰਦਾ ਆਪਣੀ ਵੀਡੀਓ ਬਣਾ ਕੇ ਫੇਸਬੁੱਕ ਤੋਂ ਪੈਸੇ ਵੀ ਕਮਾ ਸਕਦਾ ਹੈ ਆਪਣੀ ਅਗਰ ਉਹਦੀ ਪੋਸਟਾਂ ਨੂੰ ਲੋਕ ਪਸੰਦ ਕਰਦੇ ਹਨ ਲਾਈਕ ਕਰਦੇ ਹਨ ਤਾਂ ਹੁਣ ਉਹ ਫੇਸਬੁੱਕ ਤੋਂ ਅਰਨ ਵੀ ਪੈਸੇ ਵੀ ਅਰਨ ਕਰ ਸਕਦਾ ਹੈ ਓਕੇ